ਭਾਰਤ ਨੇ ਨਜਦੀਕੀ ਖੇਤਰ ਵਿੱਚ ਬਹੁਤ ਹੀ ਜ਼ਿਆਦਾ ਤਰੱਕੀ ਕਰੀ ਹੈ ਅਤੇ ਸਿੱਖਿਆ ਦੇ ਖੇਤਰ ਵਿੱਚ ਵੀ ਭਾਰਤ ਨੇ ਬਹੁਤ ਹੀ ਜ਼ਿਆਦਾ ਤਰੱਕੀ ਕਰੀ ਹੈ ਜਦੋਂ ਕੇ ਕਰੋਨਾ ਹੋਇਆ ਸੀ ਓਦੋਂ ਪੜ੍ਹਾਈ ਦਾ ਨੁਕਸਾਨ ਜਮ੍ਹਾਂ ਵੀ ਨਹੀਂ ਹੋਇਆ ਅਤੇ ਘਰ ਬੈਠ ਕੇ ਬੱਚਿਆਂ ਦੀਆਂ ਔਨਲਾਇਨ ਕਲਾਸਾਂ ਲੱਗੀਆਂ ਅਤੇ ਪੜ੍ਹਾਈ ਬਹੁਤ ਪੜ੍ਹਾਈ ਜਾਰੀ ਰਹੀ ਬੱਚਿਆਂ ਦੀ ਮਨੋਰੰਜਨ ਦੇ ਸਾਧਨ ਵਿੱਚ ਫੂਨ ਦੀ ਫੂਨ ਦੀ ਜਾਂਚ ਕੀਤੀ ਗਈ ਫੂਨ ਦੀ ਜਾਂਚ ਦੇ ਕਾਰਨ ਸਾਨੂੰ ਬਾਹਰ ਕਿਤੇ ਜਾਣ ਦੀ ਲੋੜ ਨਹੀਂ ਸਾਡਾ ਘਰ ਬੈਠ ਕੇ ਹੀ ਬਹੁਤ ਜ਼ਿਆਦਾ ਮਨੋਰੰਜਨ ਹੋ ਜਾਂਦਾ ਹੈ ਅਤੇ ਸਾਨੂੰ ਕੋਈ ਵੀ ਟਿਕਟ ਬੁੱਕ ਕਰਾਉਣੀ ਹੈ ਜਾਂ ਕਿਸੇ ਨੂੰ ਪੈਸੇ ਟਰਾਂਸਫਰ ਕਰਨੇ ਹਨ ਜਾਂ ਸਾਨੂੰ ਕੋਈ ਵੀ ਟਿਕਟ ਜਾਂ ਕੁਛ ਔਨਲਾਇਨ ਖਰੀਦਣਾ ਹੋਵੇ ਜਾਂ ਕਰਨਾ ਹੋਵੇ ਤਾਂ ਅਸੀਂ ਘਰ ਬੈਠ ਕੇ ਕਰ ਸਕਦੇ ਹਾਂ ਤਾਂ ਅਸੀਂ ਘਰ ਬੈਠ ਕੇ ਕਰ ਸਕਦੇ ਹਾਂ ਅਤੇ ਨਜ਼ਦੀਕੀ ਖੇਤਰ ਅਤੇ ਵਪਾਰ ਦੇ ਖੇਤਰ ਵਿੱਚ ਭਾਰਤ ਨੇ ਬਹੁਤ ਤਰੱਕੀ ਕਰੀ ਹੈ ਫੂਨ 'ਤੇ ਹੀ ਸਾਡੇ ਘਰ ਬੈਠ ਕੇ ਹੀ ਵ ਵਪਾਰ ਹੋ ਜਾਂਦਾ ਹੈ ਅਤੇ ਅਸੀਂ ਘਰ ਬੈਠੇ ਹੀ ਕੁਛ ਵੀ ਕੋਈ ਵੀ ਚੀਜ਼ ਖਰੀਦ ਸਕਦੇ ਹਾਂ ਇਸ ਨਾਲ ਸਾਡਾ ਬਹੁਤ ਹੀ ਜ਼ਿਆਦਾ ਫਾਇਦਾ ਹੁੰਦਾ ਹੈ ਟੈਮ ਬੱਚਤ ਵੀ ਹ ਜ਼ਿਆਦਾ ਹੁੰਦੀ ਹੈ ਅਤੇ ਸਾਨੂੰ ਬਹੁਤ ਹੀ ਜ਼ਿਆਦਾ ਸਕੂਨ ਮਿਲਦਾ ਹੈ ਕਿ ਘੱਟ ਸਮੇਂ ਵਿੱਚ ਹੀ ਬਹੁਤ ਜ਼ਿਆਦਾ ਚੀਜ਼ਾਂ ਖਰੀਦੀਆਂ ਜਾਂਦੀਆਂ ਹਨ ਵਪਾਰ ਦੇ ਸਾਧਨ ਵਿੱਚ ਵੀ ਬਹੁਤ ਜ਼ਿਆਦਾ ਤਰੱਕੀ ਹੋਈ ਹੈ ਅਤੇ ਭਾਰਤ ਨੇ ਪਹਿਲੇ ਦਿਨੋਂ ਹੀ ਬਹੁਤ ਹੀ ਜ਼ਿਆਦਾ ਤਰੱਕੀ ਕਰੀ ਹੈ ਅਤੇ ਸਾਨੂੰ ਕੋਈ ਵੀ ਮੁਸ਼ਕਲ ਦਾ ਸਾਹਮਣਾ ਨਹੀਂ ਕਰਨਾ ਪੈਂਦਾ ਉਸ ਇਸ ਲਈ ਸਾਨੂੰ ਭਾਰਤ ਵਿੱਚ ਰਹਿਣਾ ਬਹੁਤ ਹੀ ਜ਼ਿਆਦਾ ਪਸੰਦ ਹੈ ਅਤੇ ਭਾਰਤ ਸਾਥੋਂ ਛੱਡ ਨਹੀਂ ਹੁੰਦਾ ਭਾਰਤ ਵਿੱਚ ਰਹਿਣਾ ਸਾਨੂੰ ਬਹੁਤ ਹੀ ਵਧੀਆ ਲੱਗਦਾ ਹੈ ਇੱਥੇ ਘੁੰਮਣ ਨੂੰ ਬਹੁਤ ਸਾਰੀਆਂ ਸਥਾਨਾਂ ਹਨ ਭਾਰਤ ਵਿੱਚ ਬਹੁਤ ਹੀ ਜ਼ਿਆਦਾ ਵਧੀਆ ਸਥਾਨਾਂ ਬਣੀਆਂ ਹੋਈਆਂ ਹਨ ਘੁੰਮਣ ਲਈ